ਹਾਂਜੀ

ਹਾਂਜੀ ਹਾਂਜੀ ਤੁਹਾਡੀ ਅਪੁਆਇੰਟਮੈਂਟ ਤਾਂ ਸ਼ਾਮ ਪੰਜ ਵਜੇ ਦੀ ਸੀ ਅਤੇ ਪਹਿਲਾਂ ਤਾਂ ਕਾਫੀ ਅਪੁਆਇੰਟਮੈਂਟ ਨੇ ਜੇ ਉਹਨਾਂ 'ਚ ਕੋਈ ਕਸਟਮਰ ਓ ਉਹਨਾਂ 'ਚ ਪੇਸ਼ੰਟ ਕੋਈ ਮਿਸ ਹੋ ਗਿਆ ਤਾਂ ਫਿਰ ਤਾਂ ਤੁਹਾਡੀ ਪਹਿਲਾਂ ਆ ਸਕਦੀ ਹੈ ਕੋਈ ਨਹੀਂ ਉਦੋਂ ਸਾਡੇ ਚੈੱਕ ਅਪ ਕਰ ਲਵਾਂਗੇ ਸਾਰਾ ਬੋਡੀ ਦਾ ਅਤੇ ਦੇਖਦੇ ਹਾਂ ਉਸ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਮਿਲ ਪਾਵੇਗੀ ਅਪੁਆਇੰਟਮੈਂਟ ਕਿ ਨਹੀਂ ਹਾਂਜੀ ਅਤੇ ਤੁਸੀਂ ਇੱਕ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਇਓ ਨਾਲ ਅਧਾਰ ਕਾਰਡ 'ਤੇ ਫੋਨ ਨੰਬਰ ਹੋਣਾ ਚਾਹੀਦਾ ਤੁਹਾਡਾ ਖੁਦ ਦਾ ਅਤੇ ਫੀਸ ਤਾਂ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂ ਲੈ ਆਇਓ ਜੇ ਜੇ ਹੁਣੀ ਤੁਸੀਂ ਕਰਵਾਈ ਹੈ ਦੋ ਦਿਨਾਂ ਦੇ ਵਿੱਚ ਵਿੱਚ ਤੁਸੀਂ ਪਹਿਲਾਂ ਇੱਥੋਂ ਲਈ ਕਿਤੋਂ ਹੋਰ ਦਵਾਈ ਲੈ ਗਏ ਸੀ ਕਿੱਥੋਂ ਲੈ ਗਏ ਸੀ ਅੱਛਾ ਅੱਛਾ ਕੋਈ ਨਹੀਂ ਤੁਸੀਂ ਆਪਣੀਆਂ ਪੁਰਾਣੀਆਂ ਰਿਪੋਰਟਸ ਵੀ ਨਾਲ ਲੈ ਕੇ ਆ ਜਿਓ ਜੀ ਅਤੇ ਦੇਖ ਲਵਾਂਗੇ ਰਿਪੋਰਟ ਵੀ ਦੇਖ ਲਵਾਂਗੇ ਜੇ ਕੁਛ ਲੱਗਦਾ ਹੋਇਆ ਤਾਂ ਆਪਾਂ ਨਵੇਂ ਕਰਾ ਕਰ ਲਵਾਂਗੇ ਰਿਪੋਰਟਸ ਹਾਂਜੀ ਅਤੇ ਉਹ ਹੁਣ ਮੈਨੂੰ ਲਿਸਟ ਚੈੱਕ ਕਰਨੀ ਪੈਣੀ ਹੈ ਕਿਹੜਾ ਕਿਹੜਾ ਪੇਸ਼ੰਟ ਅੱਜ ਆ ਰਿਹਾ ਫਿਰ ਮੈਂ ਕੌਲ ਕਰਕੇ ਪੁੱਛਣਾ ਪੈਣਾ ਨਾ ਉਹਨਾਂ ਤੋਂ ਕਿਹੜਾ ਕਿਹੜਾ ਅੱਜ ਆ ਰਿਹਾ ਜਾਂ ਨਹੀਂ ਫਿਰ ਜੇ ਉਹਨਾਂ 'ਚ ਕੋਈ ਮਿਸ ਹੋ ਗਿਆ ਫਿਰ ਤਾਂ ਤੁਹਾਡੀ ਉਹ ਉਹਦੀ ਜਗ੍ਹਾ 'ਤੇ ਹੀ ਅੰਪੁਇੰਟਮੈਂਟ ਰੱਖ ਦੇਵਾਂਗੇ ਹੁਣ ਮੈਨੂੰ ਮੈਨੂੰ ਪੰਦਰ੍ਹਾਂ ਵੀਹ ਮਿੰਟ ਲੱਗ ਜਾਣਗੇ ਫਿਰ ਮੈਂ ਤੁਹਾਨੂੰ ਪੰਦਰ੍ਹਾਂ ਵੀਹ ਮਿੰਟ ਤੱਕ ਦੱਸ ਦਿੰਦਾ ਲੈਂਦੇ ਹਾਂ ਹਾਂ ਅਤੇ ਤੁਸੀਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਇਓ ਪੁਰਾਣੀਆਂ ਰਿਪੋਰਟਸ ਲੈ ਕੇ ਆ ਜਿਓ ਅਤੇ ਫੀਸ ਚਾਰਜਿਸ ਤੁਹਾਨੂੰ ਪਤਾ ਹੀ ਹੈ ਕਿੰਨੇ ਨੇ ਅਤੇ ਅਪੋਆਇੰਟਮੈਂਟ ਦੇ ਤਾਂ ਹਾਂਜੀ ਸੱਤ ਸੌ ਲੱਗਦਾ ਅਤੇ ਬਾਕੀ ਤੁਹਾਨੂੰ ਜੋ ਰਿਪੋਰਟਸ ਦਾ ਇੰਨੇ ਹੀ ਹੈ ਦੇਖੋ ਹੁਣ ਹਾਲ ਸਾਨੂੰ ਫਿਰ ਜ਼ਿਆਦਾ ਹੀ ਹੈ ਤੁਹਾਨੂੰ ਪਹਿਲਾਂ ਅਪੋਆਇੰਟਮੈਂਟ ਮਿਲ ਰਹੀ ਹੈ ਹਾਂਜੀ ਫਿਰ ਤਾਂ ਤੁਹਾਡੇ ਪੰਜ ਸੌ ਲੱਗਣੇ ਸੀ ਹੁਣ ਤਾਂ ਤੁਸੀਂ ਪਹਿਲਾਂ ਦੀ ਗੱਲ ਕਰ ਰਹੇ ਹੋ ਨਾ ਤੁਹਾਡੀ ਅਪੋਆਇੰਟਮੈਂਟ ਤਾਂ ਪੰਜ ਵਜੇ ਦੀ ਸੀ ਹ ਹਾਂ ਅਤੇ ਬਾਕੀ ਤੁਹਾਡੇ ਜੇ ਜੋ ਚੈਕਅੱਪ 'ਤੇ ਜੋ ਹੋਏਗਾ ਖਰਚਾ ਜਿਵੇਂ ਰਿਪੋਰਟਸ ਜਾਂ ਉਹਨਾਂ ਦੀ ਮੈਡੀਸਨ ਦੇਣੀ ਹੋ ਗਈ ਉਹ ਤੁਹਾਡਾ ਖੁਦ ਹੀ ਹੋਏਗਾ ਖਰਚਾ ਹਾਂਜੀ ਹਾਂ ਬਾਕੀ ਤੁਸੀਂ ਬਾਕੀ ਤੁਸੀਂ ਆਪਣੀਆਂ ਰਿਪੋਰਟਸ ਲੈ ਕੇ ਆ ਜਿਓ ਜੀ ਓਕੇ ਹਾਂਜੀ ਪੰਦਰ੍ਹਾਂ ਵੀਹ ਮਿੰਟ ਤੱਕ ਦਸ ਦਿੰਦੇ ਹਾਂ ਓਕੇ